ਹੈਲੋ ਮੈਂ ਮੰਜੂ ਬੋਲਦੀ ਪਈ ਹਾਂ ਅਤੇ ਮੈਂ ਤੁਹਾਡੇ ਕੋਲ ਔਡਰ ਕੀਤਾ ਸੀ ਸ਼ਾਹੀ ਪਨੀਰ ਨਾਨ ਅਤੇ ਪੀਜ਼ਾ ਅਤੇ ਪਰ ਜਿਹਦੇ ਵਾਸਤੇ ਔਡਰ ਕੀਤਾ ਸੀ ਉਹ ਹੁਣ ਆਪ ਖਾਣਾ ਖਾ ਕੇ ਆਏ ਹੈ ਅਤੇ ਨਾਲ ਸਾਡੇ ਵਾਸਤੇ ਵੀ ਕੁਛ ਲੈ ਆਏ ਆ ਫੂਡ ਆਈਟਮ ਅਤੇ ਹੁਣ ਮੈਂ ਉਹ ਇਸ ਕਰਕੇ ਉਹ ਰੱਦ ਕਰਦੀ ਪਈ ਹਾਂ ਤਾਂ ਤੁਸੀਂ ਉਹਦਾ ਮੈਨੂੰ ਰਿਫੰਡ ਜਲਦੀ ਤੋਂ ਜਲਦੀ ਦੇ ਦਿਉ ਤਾਂ ਕਿ ਮੈਂ ਕੋਈ ਹੋਰ ਚੀਜ਼ ਵੀ ਖਰੀਦ ਸਕਾਂ ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਮੈਨੂੰ ਜਲਦੀ ਤੋਂ ਜਲਦੀ ਇਹ ਡਿ ਡਿਲੀਵਰ ਕਰ ਦਿਉ ਅਤੇ ਮੈਂ ਤੁਹਾਡੇ ਲਈ ਇੱਕ ਰਿਫੰਡ ਦੀ ਬੇਨਤੀ ਕਰਦੀ ਹਾਂ ਅਤੇ ਜਲਦੀ ਤੋਂ ਜਲਦੀ ਮੈਨੂੰ ਇਹ ਦੇ ਦਿਉ ਤਾਂ ਕਿ ਮੈਂ ਕੋਈ ਹੋਰ ਚੀਜ਼ ਵੀ ਔਡਰ ਕਰ ਸਕਾਂ